ਸਾਡੇ ਨਵਾਂਸ਼ਹਿਰ ਜ਼ਿਲ੍ਹੇ ਦੇ ਵਿੱਚ ਮਤਲਬ ਇੱਕ ਕਲਿਆਣ ਸਿਨੇਮਾ ਹੈਗਾ ਏ ਜੀ ਇੱਕ ਥੀਏਟਰ ਅਤੇ ਉਹਦੇ ਵਿੱਚ ਮਤਲਬ ਪਿਛਲੇ ਹਫਤੇ ਜੀ ਐਨੀਮਲ ਮੂਵੀ ਲੱਗੀ ਸੀਗੀ ਜਿਹੜੀ ਕਿ ਮੈਂ ਆਪਣੇ ਯਾਰਾਂ ਦੋਸਤਾਂ ਦੇ ਨਾਲ ਦੇਖ ਕੇ ਆਇਆ ਸੀਗਾ ਅਤੇ ਮੈਨੂੰ ਆਪਣੇ ਘਰਦਿਆਂ ਨਾਲ ਵੀ ਬਹੁਤ ਜਾਣਾ ਪਸੰਦ ਹੈ ਪਰ ਉਹ ਜਿਸ ਤਰੀਕੇ ਦੀ ਮੂਵੀ ਸੀਗੀ ਮਤਲਬ ਲੜਾਈ ਝਗੜੇ ਵਾਲੀ ਸੀਗੀ ਅਤੇ ਮਤਲਬ ਮਤਲਬ ਪੂਰੀ ਧਾਕੜ ਵਾਲੀ ਮੂਵੀ ਸੀਗੀ ਜੋ ਕਿ ਘਰਦਿਆਂ ਨਾਲ ਦੇਖ ਕੇ ਮਤਲਬ ਅਜੀਬ ਜਿਹਾ ਲੱਗਦਾ ਪਰ ਜਿਸ ਕਾਰਨ ਮੈਂ ਆਪਣੇ ਯਾਰਾਂ ਦੋਸਤਾਂ ਨਾਲ ਗਿਆ ਅਤੇ ਯਾਰਾਂ ਦੋਸਤਾਂ ਨਾਲ ਮੈਨੂੰ ਬਹੁਤ ਜ਼ਿਆਦਾ ਮਜ਼ਾ ਆਇਆ ਅਤੇ ਉਹ ਮੂਵੀ ਇਸ ਤਰੀਕੇ ਦੀ ਸੀਗੀ ਕਿ ਮਤਲਬ ਕਿ ਮਤਲਬ ਐਨੀਮਲਾਂ ਬਾਰੇ ਉਹਦੇ ਵਿੱਚ ਉਹਨਾਂ ਦੇ ਵਿੱਚ ਐਨੀਮਲਾਂ ਬਾਰੇ ਦੱਸਿਆ ਦੱਸਿਆ ਗਿਆ ਅਤੇ ਮਤਲਬ ਐਨੀਮਲ ਦੀ ਰਾਖੀ ਬਾਰੇ ਵੀ ਦੱਸਿਆ ਗਿਆ ਅਤੇ ਮਤਲਬ ਹੋਰ ਵੀ ਬਹੁਤ ਚੀਜ਼ਾਂ ਦੱਸੀਆਂ ਗਈਆਂ ਅਤੇ ਜਿਹੜਾ ਕਿ ਮੈਨੂੰ ਮਤਲਬ ਪਤਾ ਲੱਗਿਆ ਕਿ ਮਤਲਬ ਇਹ ਮੂਵੀ ਮਤਲਬ ਸਾਡੇ ਅੱਗੇ ਵਾਸਤੇ ਫਿਊਚਰ ਵਾਸਤੇ ਵੀ ਮਤਲਬ ਬਹੁਤ ਵਧੀਆ ਉਹਦੇ ਵਿੱਚ ਇੱਦਾਂ ਦੀਆਂ ਗੱਲਾਂ ਸਿਖਾਈਆਂ ਵੀ ਗਈਆਂ ਹਨ ਕਿ ਮਤਲਬ ਸਾਡੇ ਅੱਗੇ ਫਿਊਚਰ ਮਤਲਬ ਬਹੁਤ ਕੁਝ ਦੱਸਿਆ ਗਿਆ ਕਿ ਇੱਦਾਂ ਇੱਦਾਂ ਕਰਨਾ ਚਾਹੀਦਾ ਕਿ ਇੱਦਾਂ ਇੱਦਾਂ ਨਹੀਂ ਚੰਗੀਆਂ ਗੱਲਾਂ ਵੀ ਸਿਖਾਈਆਂ ਗਈਆਂ ਬਹੁਤ ਸਾਰੀਆਂ